ਹਾਂ ਸਾਡੇ ਪਿੰਡ ਦੇ ਗੁਰਦੁਆਰਾ ਸਾਹਿਬ ਵਿੱਚ ਅਖੰਡ ਪਾਠਾਂ ਸਾਹਿਬ ਦੀ ਲੜੀ ਚੱਲ ਰਹੀ ਹੈ ਜਿਸ ਵਿੱਚ ਸਾਡਾ ਪਾਠ ਦਾ ਨੰਬਰ ਆ ਗਿਆ ਸੀ ਇਸ ਵਿੱਚ ਕਾਫੀ ਸਾਰੀ ਸੰਗਤ ਨੂੰ ਬੁਲਾਇਆ ਗਿਆ ਸੀ ਇਸ ਦਾ ਖਾਣਾ ਮੇਰੇ ਵੱਲੋਂ ਬਣਾਇਆ ਗਿਆ ਸੀ ਇਹ ਅਖੰਡ ਪਾਠ ਅਸੀਂ ਪਰਿਵਾਰ ਦੀ ਸੁੱਖ ਸ਼ਾਂਤੀ ਲਈ ਕਰਵਾਇਆ ਸੀ